ਸਤਿ ਸ਼੍ਰੀ ਅਕਾਲ ਜੀ ਮੈਂ ਵਿਸ਼ਾਲੀ ਸ਼ਰਮਾ ਨਿਵਾਸੀ ਪਠਾਨਕੋਟ ਦੀ ਰਹਿਣ ਵਾਲੀ ਹਾਂ ਅੱਜ ਤੋਂ ਦੋ ਦਿਨ ਪਹਿਲਾਂ ਮੈਂ ਪਠਾਨਕੋਟ ਤੋਂ ਚੰਡੀਗੜ੍ਹ ਕੁਛ ਜ਼ਰੂਰੀ ਕੰਮ ਤੋਂ ਜਾਣਾ ਸੀ ਇਸ ਲਈ ਮੈਂ ਤੁਹਾਡੀ ਸਾਈਟ ਓਲਾ ਤੋਂ ਇੱਕ ਕੈਬ ਬੁੱਕ ਕਰਵਾਈ ਸੀ ਵੈਸੇ ਤਾਂ ਮੇਰੇ ਕੋਲ ਹੋਰ ਵੀ ਬੜੇ ਸਾਧਨ ਸੀ ਜਾਣ ਲਈ ਪਰ ਮੈਂ ਸਵੇਰੇ ਜਲਦੀ ਜਾਣਾ ਸੀ ਤਾਂ ਮੈਂ ਤੁਹਾਡੇ ਤੋਂ ਕੈਬ ਆਰਡਰ ਕੀਤੀ ਅਤੇ ਪਹਿਲੀ ਗੱਲ ਤਾਂ ਮੈਂ ਸਵੇਰੇ ਚਾਰ ਵਜੇ ਜਾਣਾ ਸੀ ਅਤੇ ਤੁਹਾਡਾ ਡਰਾਈਵਰ ਤਾਂ ਚਾਰ ਵੀਹ 'ਤੇ ਆਇਆ ਜੋ ਕਿ ਪਹਿਲਾਂ ਹੀ ਮੇਰਾ ਦਿਮਾਗ ਖ਼ਰਾਬ ਕਰ ਤਾ ਉਸ ਨੇ ਲੇਟ ਆ ਕੇ ਫਿਰ ਜਿਵੇਂ ਹੀ ਮੈਂ ਕਾਰ ਵਿੱਚ ਬੈਠਣ ਲੱਗੀ ਤਾਂ ਮੈਂ ਵੇਖਿਆ ਕਿ ਕਾਰ ਦੀਆਂ ਤਾਂ ਸੀਟਾਂ ਹੀ ਫਟੀਆਂ ਸੀ ਪਰ ਮੈਂ ਲੇਟ ਹੋ ਰਹੀ ਸੀ ਅਤੇ ਮੈਂ ਉਸ ਨੂੰ ਇਗਨੋਰ ਕੀਤਾ ਫਿਰ ਜਾਂਦੇ ਜਾਂਦੇ ਰਸਤੇ ਵਿੱਚ ਇੱਕ ਹੋਰ ਪ੍ਰੋਬਲਮ ਹੋ ਗਈ ਜੋ ਕਿ ਗੱਡੀ ਪੈਂਚਰ ਹੋ ਗਈ ਜਿਸ ਨਾਲ ਮੇਰਾ ਹੋਰ ਸਮਾਂ ਬਰਬਾਦ ਹੋ ਗਿਆ ਨਾਲ ਸਭ ਤੋਂ ਵੱਡੀ ਗੱਲ ਤਾਂ ਇਹ ਸੀ ਕਿ ਉਸ ਗੱਡੀ ਦਾ ਤਾਂ ਹੋਰਨ ਵੀ ਕੰਮ ਨਹੀਂ ਕਰਦਾ ਸੀ ਜਿਸ ਨਾਲ ਮੈਨੂੰ ਬੜੀ ਹੀ ਪਰੇਸ਼ਾਨੀ ਹੋਈ ਅਤੇ ਮੈਂ ਪੂਰਾ ਤੀਹ ਮਿੰਟ ਲੇਟ ਹੋ ਗਈ ਜੋ ਕਿ ਮੇਰੇ ਲਈ ਬੜੀ ਹੀ ਵੱਡੀ ਗੱਲ ਸੀ ਪਰ ਹੁਣ ਤਾਂ ਜੋ ਹੋਇਆ ਸੋ ਹੋਇਆ ਮੈਂ ਹੁਣ ਤੁਹਾਨੂੰ ਇਹੀ ਬੇਨਤੀ ਕਰਦੀ ਹਾਂ ਕਿ ਅੱਗੇ ਤੋਂ ਤੁਸੀਂ ਕਾਰ ਵਧੀਆ ਗੱਡੀ ਲਿਆਇਓ ਅਤੇ ਮੇਰਾ ਟਾਈਮ ਬਰਬਾਦ ਨਾ ਕਰਿਓ ਮੈਂ ਤੁਹਾਨੂੰ ਇਹੀ ਬੇਨਤੀ ਕਰਦੀ ਹਾਂ ਧੰਨਵਾਦ ਜੀ